ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀ ਜਗ੍ਹਾ ਇੰਟਰਨੈੱਟ ਨੇ ਲੈ ਲਈ ਹੈ ਜਿਵੇਂ ਕਿ ਕੰਪਿਊਟਰ ਮਸ਼ੀਨਾਂ ਮਸ਼ੀਨਾਂ ਲੈਪਟੋਪ ਮੋਬਾਈਲ ਫੋਨ ਆਦਿ ਅਤੇ ਅੱਜ ਦੇ ਯੁੱਗ ਵਿੱਚ ਮੇਰੇ ਹੁੰਦਿਆਂ ਹੋਇਆਂ ਵੀ ਪਹਿਲਾਂ ਲੋਕ ਕੱਪੜੇ ਹੱਥਾਂ ਨਾਲ ਧੋਂਦੇ ਸੀ ਪਰ ਹੁਣ ਮਸ਼ੀਨਾਂ ਦੇ ਨਾਲ ਧੋਂਦੇ ਹਨ ਅਤੇ ਹਰ ਥਾਂ 'ਤੇ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਏ ਆਈ ਦੀ ਵਰਤੋਂ ਨਾਲ ਬਹੁਤ ਬਦਲਾਵ ਲਿਆਇਆ ਗਿਆ ਹੈ ਆਦਿ